ਕੁਝ ਕੋਰਸ ਅਜਿਹੇ ਹਨ ਜੋ ਸਾਨੂੰ ਤਕਨਾਲੋਜੀ ਅਤੇ ਕੰਪਿਊਟਰ ਬਾਰੇ ਸਿਖਾਉਂਦੇ ਹਨ ਜਿਵੇਂ ਕਿ ਮੈਂ ਇੱਕ ਕਮਰਸ ਦੀ ਵਿਦਿਆਰਥਣ ਰਹਿ ਚੁੱਕੀ ਹਾਂ ਅਤੇ ਮੈਨੂੰ ਤਕਨਾਲੋਜੀ ਅਤੇ ਕੰਪਿਊਟਰ ਬਾਰੇ ਵਧੇਰੇ ਜਾਣਕਾਰੀ ਹੈ ਕਿਉਂਕਿ ਇਸ ਕਮਰਸ ਵਿੱਚ ਇੱਕ ਅਜਿਹਾ ਸਬਜੈਕਟ ਹੈ ਜਿਸ ਦਾ ਨਾਂ ਈ ਬਿਜ਼ਨੈੱਸ ਹੈ ਜਿਸ ਤੋਂ ਜਿਸ ਦਾ ਮਤਲਬ ਹੈ ਇਲੈਕਟ੍ਰੋਨਿਕ ਵਪਾਰ ਜਿਸ ਨਾਲ ਸਾਨੂੰ ਨਵੀਂ ਨਵੀਂ ਤਕਨਾਲੋਜੀ ਅਤੇ ਕੰਪਿਊਟਰ ਬਾਰੇ ਪਤਾ ਲੱਗਦਾ ਹੈ ਸਕੂਲਾਂ ਵਿੱਚ ਵੀ ਕੰਪਿਊਟਰ ਬਾਰੇ ਕੰਪਿਊਟਰ ਲਈ ਇੱਕ ਵਿਸ਼ੇਸ਼ ਅਧਿਆਪਕ ਸੁਨਿਸ਼ਚਿਤ ਕੀਤਾ ਜਾਂਦਾ ਹੈ ਜੋ ਕਿ ਬੱਚਿਆਂ ਨੂੰ ਕੰਪਿਊਟਰ ਬਾਰੇ ਬਹੁਤ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਵਾਉਂਦਾ ਹੈ